ਜਦੋਂ ਮੈਂ ਆਪਣੀ ਦਸਵੀਂ ਦੇ ਕਲਾਸ ਦੇ ਵਿੱਚ ਹੁੰਦਾ ਸੀਗਾ ਤਾਂ ਮੇਰੀ ਫੇਵਰੇਟ ਮੈਡਮ ਦਾ ਜਨਮ ਦਿਨ ਸੀਗਾ ਅਤੇ ਮੈਂ ਉਹਨੂੰ ਵਿਸ਼ ਕਰਨ ਵਾਸਤੇ ਮਤਲਬ ਆਪਣੇ ਹੱਥ ਦੀ ਬਣਾਈ ਹੋਈ ਪੇਂਟਿੰਗ ਨਾਲ ਮਤਲਬ ਮੈਡਮ ਨੂੰ ਵਿਸ਼ ਕੀਤਾ ਅਤੇ ਨਾਲੇ ਮੈਡਮ ਨੂੰ ਤੋਹਫ਼ਾ ਦਿੱਤਾ ਅਤੇ ਫਿਰ ਉਸ ਤੋਂ ਬਾਅਦ ਮੈਂ ਮਤਲਬ ਮੈਡਮ ਨੂੰ ਆਪਣੇ ਸਾਰੇ ਕਲਾਸ ਦੇ ਸਾਹਮਣੇ ਤੋਹਫ਼ਾ ਦਿੱਤਾ ਅਤੇ ਵਿਸ਼ ਕੀਤਾ ਅਤੇ ਮੈਡਮ ਨੂੰ ਮੇਰੀ ਹੱਥ ਨਾਲ ਬਣੀ ਹੋਈ ਪੇਂਟਿੰਗ ਬਹੁਤ ਵਧੀਆ ਲੱਗੀ ਅਤੇ ਮੈਡਮ ਨੇ ਜਿਸ ਕਾਰਨ ਮੇਰੀ ਬਹੁਤ ਸਿਫ਼ਤ ਵੀ ਕੀਤੀ ਅਤੇ ਬਾਕੀਆਂ ਮੈਡਮਾਂ ਨੂੰ ਵੀ ਦਿਖਾਈ ਅਤੇ ਮੈਡਮ ਨੇ ਮਤਲਬ ਹੋਰ ਟੀਚਰਾਂ ਨੂੰ ਦਿਖਾਈ ਅਤੇ ਹੋਰ ਟੀਚਰਾਂ ਨੇ ਮੈਨੂੰ ਆ ਕੇ ਕਿਹਾ ਵੀ ਕੀ ਤੂੰ ਮਤਲਬ ਸਾਨੂੰ ਵੀ ਇੱਦਾਂ ਮਤਲਬ ਹੱਥ ਦਾ ਬਣਿਆ ਹੋਇਆ ਗਿਫਟ ਸਾਨੂੰ ਵੀ ਦੇ ਦੇ ਸਾਨੂੰ ਬਹੁਤ ਪਸੰਦ ਆਇਆ ਅਤੇ ਮਤਲਬ ਇਹ ਇੱਦਾਂ ਹੈ ਕਿ ਮਤਲਬ ਹੱਥਾਂ ਦੀ ਬਣੀਆਂ ਚੀਜ਼ਾਂ ਦਾ ਕੋਈ ਮੁੱਲ ਨਹੀਂ ਹੁੰਦਾ ਹੈ ਅਤੇ ਮਤਲਬ ਕਿ ਜਿੱਦਾਂ ਕਿ ਹੋਰ ਵੀ ਮਤਲਬ ਬਣੀਆਂ ਚੀਜ਼ਾਂ ਹੁੰਦੀਆਂ ਪਰ ਜਿਹੜੀ ਹੱਥ ਨਾਲ ਬਣੀ ਹੋਈ ਪੇਂਟਿੰਗ ਹੁੰਦੀ ਹੈ ਇਹਦਾ ਕੋਈ ਮੁੱਲ ਨਹੀਂ ਹੁੰਦਾ ਹੈਗਾ